ਮੈਂ ਸ਼ਹੀਦ ਭਗਤ ਸਿੰਘ ਨਗਰ ਦਾ ਰਹਿਣ ਬਸ ਰਹਿਣ ਵਾਲਾ ਹਾਂ ਜੀ ਠੀਕ ਹੈ ਜੀ ਸ਼ਹੀਦ ਭਗਤ ਸਿੰਘ ਜੀ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਉਹ ਸ਼ਹੀਦ ਹੋ ਗਏ ਅਤੇ ਉਹਨਾਂ ਨੇ ਉਹਨਾਂ ਉਹਨਾਂ ਏ ਇਸ ਲਈ ਉਹਨਾਂ ਨੂੰ ਸ਼ਹੀਦ ਸਰਦਾਰ ਭਗਤ ਸਿੰਘ ਵੱਲੋਂ ਜਾਣਿਆ ਜਾਂਦਾ ਹੈ ਠੀਕ ਹੈ ਜੀ ਜਾਣਿਆ ਜਾਂਦਾ ਹੈ ਅਤੇ ਖਿਡਾਰੀਆਂ ਏ ਇਸ ਲਈ ਖਿਡਾ ਖਿਡਾਰੀ ਵੀ ਬਹੁਤ ਬਹੁਤ ਬਹੁਤ ਦੂਰੋਂ ਆਉਂਦੇ ਸਨ ਅਤੇ ਗਰਾਊਂਡ ਬਹੁਤ ਦੂਰ ਪੈ ਜਾਂਦਾ ਹੈ ਜੀ ਉਹਨਾਂ ਨੂੰ ਨਵਾਂਸ਼ਹਿਰ ਤੋਂ ਜੀ ਬਲਾਚੌਰ ਤੱਕ ਜੀ ਬਹੁਤ ਦੂਰ ਪੈ ਜਾਂਦਾ ਜੀ ਇਸ ਲਈ ਮੈਂ ਵੀ ਖਿਡਾਰੀ ਹਾਂ ਜੀ ਮੈਂ ਇਸ ਲਈ ਦੱਸਣ ਜਾ ਰਿਹਾ ਹਾਂ ਕਿ ਸਾਨੂੰ ਨਵਾਂਸ਼ਹਿਰ ਤੋਂ ਵੀਹ ਕਿਲੋਮੀਟਰ 'ਤੇ ਪੈ ਜਾਂਦਾ ਹੈ ਜੀ ਗਰਾਊਂਡ ਠੀਕ ਹੈ ਜੀ ਸਾਨੂੰ ਸਿੱਖਿਆ ਰੁਜ਼ਗਾਰ ਬਹੁਤ ਘੱਟ ਮਿਲਦਾ ਹੈ ਜੀ ਠੀਕ ਹੈ ਜੀ ਮੈਂ ਸਿੱਖਿਆ ਰੁਜ਼ਗਾਰ ਬਾਰੇ ਬੇਨਤੀ ਕਰਦਾ ਹਾਂ ਜੀ ਸਾਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ ਅਤੇ ਸਾਨੂੰ ਬਹੁਤ ਹੀ ਜ਼ਿਆਦਾ ਦੂਰ ਪੈ ਜਾਂਦਾ ਹੈ ਜੀ ਗਰਾਊਂਡ ਜਿਵੇਂ ਆਪਾਂ ਚੰਡੀਗੜ੍ਹ ਜਾਂਦੇ ਹਾਂ ਜੀ ਚੰਡੀਗੜ੍ਹ ਸਾਨੂੰ ਪੰਦਰ੍ਹਾਂ ਹਜ਼ਾਰ ਮਿਲਦਾ ਹੈ ਜੀ ਅਤੇ ਬਲਾਚੌਰ ਸਾਨੂੰ ਦਸ ਹਜ਼ਾਰ ਰੁਪਿਆ ਮਿਲਦਾ ਹੈ ਜੀ ਠੀਕ ਹੈ ਜੀ ਤਾਂ ਸਾਨੂੰ ਚੰਡੀਗੜ੍ਹ ਦਾ ਰੁਜ਼ਗਾਰ ਮਿਲਣਾ ਸਾਨੂੰ ਸਾਨੂੰ ਸਾਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ ਜੀ ਇਸ ਲਈ ਸਾਡਾ ਆਪਣਾ ਖਰਚਾ ਵੀ ਪੂਰਾ ਨਹੀਂ ਹੁੰਦਾ ਹੈ ਠੀਕ ਹੈ ਜੀ ਇਸ ਲਈ ਆਪਾਂ ਸਿੱਖਿਆ ਰੁਜ਼ਗਾਰ ਲ ਵੱਲੋਂ ਜਾਣੇ ਜਾਂਦਾ ਹੈ ਜੀ ਸਾਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ ਜੀ